ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਲਈ ਸਾਨੂੰ ਬਹੁਤ ਸਾਰੇ ਉਪਰਾਲੇ ਕਰਨੇ ਪੈਣੇ ਹਨ ਕਿਉਂਕਿ ਸਾਡੀ ਇਹ ਵਿਰਾਸਤ ਅਲੋਪ ਹੋ ਰਹੀ ਹੈ ਅਤੇ ਸਾਨੂੰ ਇਸੇ ਵਿਰਾਸਨ ਵਿਰਾਸਤ ਨੂੰ ਸਾਂਭਣ ਦੀ ਬਹੁਤ ਹੀ ਜ਼ਰੂਰਤ ਹੈ ਸਾਡਾ ਸੱਭਿਆਚਾਰ ਇਹ ਮਾਡਰਾਈਜੇਸ਼ਨ ਦੇ ਕਰਕੇ ਜ਼ਿਆਦਾ ਪਿੱਛੇ ਜਾ ਰਿਹਾ ਹੈ ਸਾਨੂੰ ਆਪਣਾ ਸੱਭਿਆਚਾਰ ਨਹੀਂ ਭੁੱਲਣਾ ਚਾਹੀਦਾ ਸੱਭਿਆਚਾਰ ਨੂੰ ਅਸੀਂ ਸਾਂਭਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਆਪਣੀ ਕਿਤਾਬਾਂ ਦੇ ਵਿੱਚ ਲੈਸਨ ਪੜ੍ਹਾਏ ਜਾਣੇ ਚਾਹੀਦੇ ਹਨ ਕਿ ਸਾਡੇ ਪੁਰਾਣੇ ਸੱਭਿਆਚਾਰ ਦੇ ਵਿੱਚ ਕੀ ਕੀ ਸੀ ਕੀ ਪੋਸ਼ਾਕਾਂ ਪਾਈਆਂ ਜਾਂਦੀਆਂ ਸੀ ਕਿਸ ਤਰ੍ਹਾਂ ਬੋਲਿਆ ਜਾਂਦਾ ਸੀ ਕਿਸ ਤਰ੍ਹਾਂ ਕਿਸੇ ਨਾਲ ਆਪਣੇ ਵਿਚਾਰ ਵਟਾਂਦਰੇ ਪੇਸ਼ ਕੀਤੇ ਜਾਂਦੇ ਸੀ ਕਿਸ ਤਰ੍ਹਾਂ ਰਹਿਣਾ ਸਹਿਣਾ ਖਾਣਾ ਪੀਣਾ ਸਭ ਸਾਡਾ ਇਹ ਪਾਠਾਂ ਦੇ ਵਿੱਚ ਦਰਸਾਇਆ ਜਾਣਾ ਚਾਹੀਦਾ ਹੈ ਦੂਜਾ ਇਹ ਕਿ ਇਸ ਵਿਰਾਸਤ ਨੂੰ ਅਸੀਂ ਕੋਈ ਮਿਊਜ਼ੀਅਮ ਬਣਾ ਕੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਅਤੇ ਕੰਧਾਂ 'ਤੇ ਚਿੱਤਰ ਕੇ ਇਹਨਾਂ ਨੂੰ ਸੰਭਾਲ ਕੇ ਅਸੀਂ ਰੱਖ ਸਕਦੇ ਹਾਂ ਤਾਂ ਜੋ ਸਾਡੀ ਅਗਲੀ ਪੀੜ੍ਹੀ ਨੂੰ ਇਸ ਚੀਜ਼ ਦਾ ਪਤਾ ਚੱਲੇ